ਹਾਂਜੀ ਮੈਂ ਯੋਗਾ ਕਰਕੇ ਬਹੁਤ ਖੁਸ਼ ਹੋਈ ਹਾਂ ਅਤੇ ਮੇਰੇ ਮੇਰਾ ਸਰੀਰ ਬਹੁਤ ਵਧੀਆ ਰਹਿੰਦਾ ਹੈ ਇਹ ਯੋਗਾ ਜਿਹੜੀ ਇਹ ਦਿਮਾਗੀ ਪਰੇਸ਼ਾਨੀ ਨੂੰ ਠੀਕ ਕਰਦੀ ਹੈ ਅਤੇ ਮਨ ਵੀ ਖੁਸ਼ ਰਹਿੰਦਾ ਹੈ ਯੋਗਾ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਔਰ ਯੋਗਾ ਕਰਕੇ ਲੇ ਜਨਾਨੀਆਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਹਨ ਅਤੇ ਦਿਮਾਗੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ ਸੂਰਜ ਨਮਸਕਾਰ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ ਕਪਾਲਭਾਤੀ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ ਯੋਗਾ ਤਾਂ ਰੋਜ਼ ਸਵੇਰੇ ਉੱਠ ਕੇ ਕਰਨੀ ਚਾਹੀਦੀ ਹੈ ਔਰ ਕਰਦੀ ਵੀ ਹਾਂ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਯੋਗਾ ਕਰਨ ਨਾਲ ਹਰ ਬਿਮਾਰੀ ਸਿਰ ਦਰਦ ਪੇਟ 'ਚ ਕੋਈ ਤਕਲੀਫ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਗੋਡਿਆਂ 'ਚ ਕੋਈ ਤਕਲੀਫ ਹੋਵੇ ਉਹ ਯੋਗਾ ਕਰਨ ਨਾਲ ਠੀਕ ਹੋ ਜਾਂਦੀ ਹੈ ਯੋਗਾ ਵੀ ਕਿਸੇ ਅੱਛੀ ਜਗ੍ਹਾ ਤੋਂ ਕਰਨਾ ਚਾਹੀਦਾ ਹੈ ਯੋਗਾ ਕਰਕੇ ਮਨ ਖੁਸ਼ ਹੋ ਜਾਂਦਾ ਹੈ ਅਤੇ ਦਿਮਾਗੀ ਪਰੇਸ਼ਾਨੀ ਠੀਕ ਹੋ ਜਾਂਦੀ ਹੈ ਯੋਗਾ ਸਭ ਨੂੰ ਹੀ ਕਰਨੀ ਚਾਹੀਦੀ ਹੈ ਯੋਗਾ ਬਿਲਕੁਲ ਸਭ ਤੋਂ ਪਰਫੈਕਟ ਇਲਾਜ ਸਭ ਤੋਂ ਵਧੀਆ ਇਲਾਜ ਹੈ